ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀ ਹੈ ਅਤੇ ਮੈਂ ਗੁਰਦਾਸਪੁਰ ਤੋਂ ਬੋਲਦੀ ਪਈ ਹੈਗੀ ਹਾਂ ਅਤੇ ਸਾਡਾ ਮ ਮੁਹੱਲਾ ਜਿਹੜਾ ਸ਼ੰਕਰ ਨਗਰ ਹੈਗਾ ਹੈ ਹਾਂਜੀ ਮੈਂ ਕਾਫ਼ੀ ਟਾਈਮ ਤੋਂ ਜਿਹੜੇ ਆਨਲਾਈਨ ਜਿਹੜਾ ਮੈਂ ਸਮਾਨ ਪ੍ਰੋਡਕਟ ਮੰਗਵਾ ਰਹੀ ਹਾਂ ਅਤੇ ਮੈਨੂੰ ਅਗਲਾ ਬਹੁਤ ਵਧੀਆ ਪ੍ਰੋਡਕਟ ਲੱਗ ਰਹੇ ਨੇ ਅਤੇ ਇਹ ਜਿਹੜੇ ਪ੍ਰੋਡਕਟ ਸਰ ਜੋ ਜਿੰਨੇ ਵੀ ਮੇਰੇ ਪ੍ਰੋਡਕਟ ਆਏ ਹੈ ਅੱਜ ਤੱਕ ਮਤਲਬ ਕੋਈ ਇਹਨਾਂ ਦੀ ਕੰਪਲੇਂਟ ਨਹੀਂ ਗੇ ਸਾਰੇ ਪ੍ਰੋਟੈਕਟ ਜਿਹੜੇ ਹੈਗੇ ਆ ਬਹੁਤ ਵਧੀਆ ਹੁੰਦੇ ਹੈਗੇ ਆ ਅਤੇ ਹਾਂਜੀ ਮੈਂ ਫਸਟ ਟਾਈਮ ਮੇਰੇ ਨਾਲ ਇਸ ਨੂੰ ਹੋਇਆ ਗਾ ਕਿ ਮੈਂ ਇੱਕ ਪ੍ਰੋਡਕਟ ਮੰਗਵਾਇਆ ਆਪਣੀ ਸਕਿੰਨ ਨਾਲ ਰਿਲੇਟਡ ਹਾਂਜੀ ਮੇਰੀ ਸਕਿੰਨ 'ਤੇ ਬਹੁਤ ਸਾਰੀਆਂ ਜਾਈਆਂ ਪਈਆਂ ਮਤਲਬ ਉਹ ਛਾਈਆਂ ਪੈ ਗਈਆਂ ਸੀਗੀਆਂ ਅਤੇ ਮੈਨੂੰ ਕਿਸੇ ਨੇ ਮਤਲਬ ਰਿਕਮੈਂਡਡੇਸ਼ਨ ਦਿੱਤੀ ਕਿਸੇ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਆਨਲਾਈਨ ਜਿਹੜੀ ਹੈਗੀ ਆ ਇਹ ਨਾਈਟ ਕਰੀਮ ਮੰਗਵਾਓ ਮਤਲਬ ਕਹਿੰਦੇ ਕਿ ਜਿਹੜੀ ਔਨਲਾਈਨ ਨਾਈਟ ਕਰੀਮ ਹੈਗੀ ਆ ਇਹ ਬਹੁਤ ਵਧੀਆ ਮਿਲਦੀ ਹੈਗੀ ਹੈ ਤੁਸੀਂ ਵੀ ਇੱਕ ਵਾਰੀ ਉਹਨੂੰ ਯੂਜ ਕਰਕੇ ਦੇਖੋ ਅਤੇ ਮੈਂ ਵੀ ਮਤਲਬ ਉਹਨਾਂ ਦਾ ਕਹਿਣਾ ਮੰਨ ਲਿਆ ਮੈਂ ਵੀ ਇਹਨਾਂ ਦੇ ਕਹਿਣੇ 'ਚ ਆ ਗਈ ਅਤੇ ਮੈਂ ਕਿਹਾ ਇਹਨਾਂ ਦੇ ਮਤਲਬ ਜਿਹੜੀਆਂ ਛਾਈਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਸਕਿੰਨ ਦੇ ਫ਼ਰਕ ਪੈ ਗਿਆ ਅਤੇ ਮੈਂ ਵੀ ਉਹ ਮੰਗਵਾ ਕੇ ਦੇਖਾਂ ਮੈਂ ਵੀ ਉਹਦੀ ਮਤਲਬ ਆਨਲਾਈਨ ਜਿਹੜਾ ਗਾ ਮੈਂ ਵੀ ਆਨਲਾਈਨ ਬੁੱਕ ਕਰਵਾ ਦਿੱਤੀ ਉਹ ਕਰੀਮ ਮਤਲਬ ਉਹ ਕਰੀਮ ਤਾਂ ਇੱਕ ਤਾਂ ਮਤਲਬ ਬਹੁਤ ਲੇਟ ਆ ਪਹੁੰਚੀ ਮੇਰੇ ਕੋਲ ਟਾਈਮ 'ਤੇ ਉਹ ਕਰੀਮ ਆਈ ਨਹੀਂ ਮਤਲਬ ਅੱਗੇ ਜਿਹੜੀ ਮੇਰੀ ਕਰੀਮਸ ਵਗੈਰਾ ਪ੍ਰੋਡਕਟ ਸੀ ਉਹ ਮਤਲਬ ਸੈਵਨ ਮਤਲਬ ਸੈਵਨ ਡੇ ਦੇ ਵਿੱਚ ਵਿੱਚ ਉਹ ਆ ਜਾਂਦੀਆਂ ਸੀ ਪਰ ਇਹ ਜਿਹੜੀ ਨਾਈਟ ਕਰੀਮ ਹੈਗੀ ਮੇਰੀ ਦਸ ਦਿਨ ਦੇ ਵਿੱਚ ਵਿੱਚ ਆਈ ਇਹ ਕਰੀਮ ਬਹੁਤ ਲੇਟ ਆਈ ਇੱਕ ਤਾਂ ਮਤਲਬ ਇਹ ਲੇਟ ਆਈ ਦੂਸਰੀ ਇਹਦੀ ਜਿਹੜੀ ਮੈਨੂੰ ਰਿਜਲਟ ਸੀ ਉਹ ਵਧੀਆ ਨਹੀਂ ਮਿਲੇ ਕਿਉਂਕਿ ਇਹਦੇ ਲਗਾਉਣ ਨਾਲ ਮੈਨੂੰ ਕੋਈ ਫ਼ਰਕ ਨਹੀਂ ਪਿਆ ਮਤਲਬ ਮੈਨੂੰ ਨਾ ਮਤਲਬ ਇੱਕ ਵੰਨ ਮੰਨਥ ਪੂਰਾ ਕੰਪਲੀਟ ਹੋ ਗਿਆ ਇਹਨੂੰ ਲਗਾਉਂਦੇ ਮੈਨੂੰ ਉਹਦੇ ਨਾਲ ਕੋਈ ਮਤਲਬ ਮਤਲਬ ਫ਼ਰਕ ਨਹੀਂ ਪਿਆ ਮਤਲਬ ਮੇਰੀ ਜਿਹੜੀਆਂ ਮੇਰੀਆਂ ਛਾਈਆਂ ਬੜੀਆਂ ਮੇਰੀਆਂ ਛਾਈਆਂ ਮੂੰਹ ਦੀਆਂ ਹੈਗੀਆਂ ਉਸ ਤਰ੍ਹਾਂ ਦੇ ਉਸ ਤਰਾਂ ਮਤਲਬ ਥੋੜ੍ਹੀਆਂ ਹੋਰ ਡਾਰਕ ਹੋ ਗਈਆਂ ਬਿਲਕੁਲ ਨੀ ਇਹਦੇ ਨਾ ਮੈਨੂੰ ਫ਼ਰਕ ਮੈਨੂੰ ਵਧੀਆ ਨਹੀਂ ਲੱਗੀ ਇਸ ਤਰ੍ਹਾਂ ਕਦੇ ਹੋਇਆ ਨਹੀਂ ਵੀ ਮੈਂ ਕੋਈ ਵੀ ਕਰੀਮ ਮੰਗਵਾਈ ਔਰ ਮੈਨੂੰ ਨਹੀਂ ਅੱਛੀ ਲੱਗੀ ਪਰ ਇਹ ਕਰੀਮ ਬਿਲਕੁਲ ਨਹੀਂ ਸਹੀ ਲੱਗੀ ਮੈਂ ਤੁਹਾਨੂੰ ਇਹ ਰਿਕੁਐਸਟ ਕਰਦੀ ਹਾਂ ਕਿ ਇਹ ਜਿਹੜੀ ਕਰੀਮ ਹੈਗੀ ਆ ਤੁਸੀਂ ਅੱਗੇ ਤੋਂ ਕਿਸੇ ਨੂੰ ਜਿਹੜੀ ਪ੍ਰੋਡਕਟ ਜਿਹੜਾ ਹੈਗਾ ਸੇਲ ਨਾ ਕਰਿਓ ਥੈਂਕ ਯੂ ਧੰਨਵਾਦ